ਮੈਨੂੰ ਰਸੋਈ ਦੇ ਵਿੱਚ ਕੰਮ ਕਰਨਾ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਜਿਵੇਂ ਯੂਟੀਊਬ ਤੋਂ ਦੇਖ ਕੇ ਕੁਛ ਨਾ ਕੁਛ ਬਣਾਉਂਦੇ ਰਹਿਣਾ ਘਰ ਦੇ ਵਿੱਚ ਕੋਈ ਨਾ ਕੋਈ ਪਕਵਾਨ ਪਕਾਉਣਾ ਪਹਿਲਾਂ ਯੂਟੀਊਬ ਤੋਂ ਦੇਖ ਲੈਣਾ ਫਿਰ ਬਣਾਉਣਾ ਜਿਵੇਂ ਮੈਂ ਯੂਟੀਊਬ ਤੋਂ ਦੇਖ ਕੇ ਇੱਕ ਵਾਰ ਜਿਹੜੇ ਹੈਗੇ ਐਗੇ ਸਮੋਸੇ ਹੈਗੇ ਜਿਹੜੇ ਉਹ ਘਰ ਵਿੱਚ ਟਰਾਈ ਕੀਤੇ ਉਹਦੇ ਵਾਸਤੇ ਮੈਨੂੰ ਮੈਦੇ ਦੀ ਲੋੜ ਪਈ ਉਹਦੇ ਵਾਸਤੇ ਮੈਨੂੰ ਮੈਦੇ ਦੀ ਲੋੜ ਪਈ ਐਂਡ ਆਲੂ ਪਏ ਇਹ ਮਟਰ ਇਹ ਸਾਰਾ ਕੁਛ ਸਮਾਨ ਜਿਹੜਾ ਹੈਗਾ ਮੈਨੂੰ ਲਿਆ ਪਿਆ ਮਤਲਬ ਇਸ ਦੀ ਲੋੜ ਪਈ ਅਤੇ ਇਹ ਸਾਰਾ ਸਮਾਨ ਜਿਹੜਾ ਹੈਗਾ ਮੈਨੂੰ ਈਜ਼ੀਲੀ ਘਰ ਦੇ ਵਿੱਚੋਂ ਜਿਹੜਾ ਹੈਗਾ ਮਿਲ ਗਿਆ ਮੈਂ ਮੈਦੇ ਦਾ ਆਟਾ ਗੁੰਨਿਆ ਉਸ ਤੋਂ ਬਾਅਦ ਮੈਂ ਉਹਨੂੰ ਕੁਛ ਕੁ ਟਾਈਮ ਦੇ ਲਈ ਰੱਖ ਦਿੱਤਾ ਤਾਂ ਕਿ ਉਹਦੇ ਵਿੱਚ ਗਰੇਸ ਆ ਜਾਵੇ ਆਟੇ ਦੇ ਵਿੱਚ ਮੈਂ ਆਲੂ ਉਬਾਲੇ ਮਟਰ ਉਬਾਲੇ ਉਹਨਾਂ ਦੇ ਵਿੱਚ ਲੂਣ ਮਿਰਚ ਪਾ ਕੇ ਮਸਾਲੇ ਸਾਰੇ ਜਿਹੜੇ ਹੈਗੇ ਆ ਪਾ ਕੇ ਮੈਂ ਉਹਨਾਂ ਤੋਂ ਚੰਗੀ ਤਰ੍ਹਾਂ ਮਿਕਸਚਰ ਬਣਾਇਆ ਉਹ ਤੋਂ ਬਾਅਦ ਮੈਂ ਸਮੋਸੇ ਸੀਗੀ ਜਿਹੜਾ ਆਟਾ ਸੀਗਾ ਮੈਦੇ ਦਾ ਜਿਹੜਾ ਲਿੱਤਾ ਉਹ ਸਮੌਸਿਆ ਦੇ ਲਈ ਤਿਆਰ ਕੀਤਾ ਉਹਨੂੰ ਚੰਗੀ ਤਰ੍ਹਾਂ ਉਹਦੇ ਸਮੌਸੇ ਦੀ ਸ਼ੇਪ ਦਿੱਤੀ ਉਹਨੂੰ ਬਣਾਇਆ ਉਹਦੇ ਵਿੱਚ ਜਿਹੜੇ ਹੈਗੇ ਐਗੇ ਸਮੋਸੇ ਜਿਹੜੇ ਹੈਗੇ ਐਗੇ ਸਮੋਸੇ ਦਾ ਜਿਹੜਾ ਮਿਕਸਚਰ ਸੀਗਾ ਆਲੂ ਮਟਰ ਅਤੇ ਮਸਾਲੇ ਵਾਲਾ ਉਹਦੇ ਵਿੱਚੋਂ ਮੈਂ ਉਹਨੂੰ ਫਿਲ ਕੀਤਾ ਅਤੇ ਉਹਨੂੰ ਕੁਛ ਟਾਈਮ ਦੇ ਲਈ ਰੱਖ ਦਿੱਤਾ ਵਿੱਚ ਉਹਨੂੰ ਮੈਂ ਤੇਲ ਦੇ ਵਿੱਚ ਦੀ ਤਲਿਆ ਅਤੇ ਨਾਲ ਦੀ ਨਾਲ ਇਹ ਜਿਹੜੀ ਹੈਗੀ ਐਗੇ ਮੈਂ ਇੱਕ ਸਾਈਡ ਦੇ ਉੱਪਰ ਜਿਹੜੀ ਹੈਗੀ ਹੈਗੀ ਸੋਸ ਤਿਆਰ ਕੀਤੀ ਅਤੇ ਨਾਲ ਹੀ ਮੈਂ ਜਿਹੜੀ ਹੈਗੀ ਐਗੀ ਜਿਹੜੀ ਹੈਗੀ ਆ ਛੋਲੇ ਦੀ ਆਲੂ ਛੋਲੇ ਦੀ ਜਿਹੜੀ ਹੈਗੀ ਹੈਗੀ ਸਬਜ਼ੀ ਦਾਲ ਤਿਆਰ ਕੀਤੀ ਕਿਉਂਕਿ ਕਈ ਜਿਹੜੇ ਹੈਗੇ ਮੇਰੇ ਘਰ ਦੇ ਹੈਗੇ ਆ ਉਹ ਸੋਸ ਨਾਲ ਸਮੋਸਾ ਖਾਣਾ ਪਸੰਦ ਕਰਦੇ ਹੈਗੇ ਆ ਅਤੇ ਕਈ ਦਾਲ ਦੇ ਨਾਲ ਖਾਣਾ ਪਸੰਦ ਕਰਦੇ ਹੈਗੇ ਆ ਬਟ ਜਿਹੜਾ ਉਹ ਮੈਂ ਪਕਵਾਨ ਬਣਾਇਆ ਸਮੋਸੇ ਜਿਹੜੇ ਬਣਾਏ ਉਹ ਬਹੁਤ ਜ਼ਿਆਦਾ ਸੁਆਦ ਬਣੇ ਬਟ ਮੈਨੂੰ ਉਹਨਾਂ ਦੇ ਉੱਪਰ ਥੋੜ੍ਹਾ ਜਿਹਾ ਜ਼ਿਆਦਾ ਜਿਹੜਾ ਹੈਗਾ ਗਾ ਟਾਈਮ ਲੱਗ ਗਿਆ ਬਟ ਉਹ ਟੇਸਟੀ ਬਹੁਤ ਜ਼ਿਆਦਾ ਬਣੇ ਸੀ ਮੇਰਾ ਐਕਸਪੀਰੀਅਸ ਉਹਨਾਂ ਦਾ ਬਹੁਤ ਵਧੀਆ ਰਿਹਾ ਉਸ ਦਿਨ ਤਾਂ ਮੇਰੀ ਸਾਰਿਆਂ ਨੇ ਤਰੀਫ਼ ਕੀਤੀ ਦੂਜੇ ਪਾਸੇ ਜਿਹੜੇ ਹੈਗਾ ਗਾ ਵੀ ਮੈਂ ਇੱਕ ਦਿਨ ਮੈਂ ਚੌਲ ਟਰਾਈ ਕੀਤੇ ਮੈਂ ਨਮਕ ਵਾਲੇ ਚੌਲ ਬਣਾਏ ਉਹ ਜਿਹੜੇ ਹੈਗੇ ਮੇਰੇ ਦਸ ਕੁ ਮਿੰਟਾਂ ਦੇ ਵਿੱਚ ਜਿਹੜੇ ਹੈਗੇ ਉਹ ਤਿਆਰ ਹੋ ਗਏ ਅਤੇ ਉਹ ਮੈਨੂੰ ਬਹੁਤ ਜ਼ਿਆਦਾ ਸੁਆਦ ਲੱਗੇ ਉਹਦੇ ਵਿੱਚ ਮੈਂ ਸਾਰੇ ਮਸਾਲੇ ਪਾਏ ਅਤੇ ਉਹ ਤੋਂ ਬਾਅਦ ਜਿਹੜੇ ਹੈਗੇ ਉਹ ਮੈਂ ਖਾਦੇ ਅਤੇ ਮੈਨੂੰ ਉਹ ਬਹੁਤ ਜ਼ਿਆਦਾ ਵਧੀਆ ਲੱਗੇ ਅਤੇ ਮੈਨੂੰ ਉਹ ਬਣਾਉਣੇ ਵੀ ਸੌਖੇ ਲੱਗੇ ਅਤੇ ਬਣ ਵੀ ਥੋੜ੍ਹੇ ਟਾਈਮ ਦੇ ਗਏ 'ਚ ਗਏ ਅਤੇ ਉਹ ਮੈਨੂੰ ਜ਼ਿਆਦਾ ਵਧੀਆ ਲੱਗੇ ਕਿਉਂਕਿ ਜੇ ਘਰ ਵਿਚ ਕੋਈ ਵੀ ਆਉਂਦਾ ਤਾਂ ਉਹ ਮੈਂ ਜਲਦੀ ਜਿਹੜੇ ਹੈਗੇ ਐਗੇ ਬਣਾ ਸਕਦੀ ਹਾਂ